ਸੈਰ ਸਪਾਟਾ ਉਦਯੋਗ ਨੂੰ ਵੱਧਣ ਫੁੱਲਣ ਜਾਂ ਸੈਲਾਨੀ ਨੂੰ ਆਕਰਸ਼ਿਤ ਕਰਨ ਲਈ ਪਟਿਆਲੇ ਸ਼ਹਿਰ ਵਿੱਚ ਕਈ ਜਗ੍ਹਾਵਾਂ ਹਨ ਜਿਵੇਂ ਕਿ ਇੱਥੇ ਨੌਵੀਂ ਪਾਤਸ਼ਾਹੀ ਨੇ ਪੈਰ ਪਾਏ ਸੀ ਅਤੇ ਉਹਨਾਂ ਦੇ ਨਾਮ 'ਤੇ ਹੀ ਇੱਕ ਇੱਥੇ ਬਹੁਤ ਵੱਡਾ ਗੁਰਦੁਆਰਾ ਹੈ ਜਿਸ ਦਾ ਨਾਮ ਦੁੱਖ ਨਿਵਾਰਨ ਸਾਹਿਬ ਹੈ ਲੋਕ ਏ ਸ਼ਰਧਾਲੂ ਇੱਥੇ ਮੱਥਾ ਟੇਕਣ ਹਰ ਐਤਵਾਰ ਆਉਂਦੇ ਹਨ ਅਤੇ ਭੀੜ ਲੱਗਦੀ ਹੈ ਇੱਥੇ ਹੋਰ ਵੀ ਕਈ ਜਗ੍ਹਾਵਾਂ ਹਨ ਜਿਵੇਂ ਕਿਲ੍ਹਾ ਮੁਬਾਰਕ ਸ਼ੀਸ਼ ਮਹਿਲ ਮੋਤੀ ਬਾਗ ਅਤੇ ਛੋਟੀ ਬਾਰਾਂਦਰੀ ਹੋਰ ਵੀ ਐਵੇਂ ਦੀਆਂ ਕਈ ਜਗ੍ਹਾਵਾਂ ਹਨ ਪਾਰਕਸ ਵੀ ਹਨ ਗਾਰਡਨ ਵੀ ਹਨ ਡੀਅਰ ਪਾਰਕ ਹੋ ਗਏ ਜਿੱਦਾਂ ਇਹ ਸਭ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਹਨ ਅਤੇ ਸਰਕਾਰਾਂ ਸਰਕਾਰ ਨੂੰ ਹੋਰ ਸੈਰ ਸਪਾਟੇ ਦੀਆਂ ਚੀਜ਼ਾਂ ਨੂੰ ਬਿਹਤਰ ਬਣਾਉਣ ਲਈ ਉਹਨਾਂ ਦੀ ਮਸ਼ਹੂਰੀ ਕਰਨੀ ਚਾਹੀਦੀ ਹੈ ਉੱਥੇ ਦੇ ਇੰਨਫਰਾਸਕਚਰ ਨੂੰ ਵਧੀਆ ਬਣਾਉਣਾ ਚਾਹੀਦਾ ਹੈ ਰੈਣ ਬਸੇਰਾ ਵਧੀਆ ਕਰਨਾ ਚਾਹੀਦਾ ਹੈ ਤਾਂ ਕਿ ਜਦੋਂ ਉਹ ਲੋਕ ਉੱਥੇ ਜਾਣ ਤਾਂ ਉਹਨਾਂ ਨੂੰ ਕੋਈ ਜ਼ਿਆਦਾ ਔਖਾ ਔਖ ਨਾ ਹੋਵੇ ਤਾਂ ਉਹ ਅਸਾਨੀ ਨਾਲ ਉੱਥੇ ਘੁੰਮ ਸਕਣ ਮੈਂ ਕੁਝ ਥਾਵਾਂ ਦੇ ਨਾਮ ਦੱਸਣਾ ਚਾਹੁੰਦਾ ਹਾਂ ਜੋ ਸੁੰਦਰ ਹਨ ਸੈਰ ਸਪਾਟੇ ਲਈ ਪਰ ਪ੍ਰਸਿੱਧ ਨਹੀਂ ਹਨ ਜਿਵੇਂ ਕਿ ਇੱਕ ਗੁਰਲੇਜ਼ ਵੈਲੀ ਹੈ ਜੰਮੂ ਕਸ਼ਮੀਰ ਦੇ ਵਿੱਚ ਉਹ ਬਹੁਤ ਹੀ ਸੋਹਣੀ ਹੈ ਉੱਥੇ ਬਰਫ ਦੀ ਚਾਦਰ ਬਹੁਤ ਅੱਛੀ ਵਿਛਦੀ ਹੈ ਅਤੇ ਹੋਰ ਨੌਰਥਈਸਟ ਵਾਲੀ ਸਾਈਡ ਵੀ ਕਈ ਥਾਵਾਂ ਹਨ ਸਿੱਕਿਮ ਦੇ ਵਿੱਚ ਗੰਗਟੋਕ ਦੇ ਨਾਲ ਕਈ ਸੋਹਣੀਆਂ ਸੋਹਣੀਆਂ ਥਾਵਾਂ ਹਨ